ਮੈਂ ਪਿਛਲੀ ਦਸ ਤਰੀਕ ਨੂੰ ਇੱਕ ਲੈਪਟੋਪ ਆਡਰ ਕੀਤਾ ਸੀ ਐਵਾਜੋਮ ਐਪ 'ਤੇ ਪਰ ਮੈਂ ਔਨਲਾਈਨ ਸ਼ੋਪਿੰਗ ਵਿੱਚ ਪਹਿਲੀ ਵਾਰ ਹੀ ਕੋਈ ਆਈਟਮ ਮੰਗਵਾਈ ਸੀ ਅਤੇ ਮੇਰਾ ਫਸਟ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ ਮੇਰਾ ਦੋਸਤ ਤਾਂ ਮੈਨੂੰ ਔਨਲਾਈਨ ਮੰਗਵਾਉਣ ਤੋਂ ਮਨਾ ਕਰ ਰਿਹਾ ਸੀ ਕਿ ਰਹਿਣ ਦੇ ਵੀ ਵਧੀਆ ਨਹੀਂ ਆਉਂਦੇ ਔਨਲਾਈਨ ਪ੍ਰੋਡਕਟ ਅਤੇ ਉਹ ਮੈਨੂੰ ਕਹਿ ਰਿਹਾ ਸੀ ਵੀ ਕਿਸੇ ਸ਼ੌਪ ਤੋਂ ਹੀ ਲੈ ਲੈਂਦੇ ਹਾਂ ਪਰ ਮੈਨੂੰ ਔਨਲਾਈਨ ਕੁਝ ਔਫਰਾਂ ਕਰਕੇ ਸਸਤਾ ਵੀ ਮਿਲ ਗਿਆ ਤਾਂ ਮੈਂ ਔਨਲਾਈਨ ਹੀ ਔਡਰ ਕਰਤਾ ਮੈਂ ਦਸ ਤਰੀਕ ਨੂੰ ਔਡਰ ਕੀਤਾ ਸੀ ਅਤੇ ਸੌਲ੍ਹਾਂ ਤਰੀਕ ਨੂੰ ਮੇਰੇ ਕੋਲ ਡਿਲੀਵਰੀ ਆਉਣੀ ਸੀ ਅਤੇ ਇਹ ਪੂਰੀ ਸੌਲ੍ਹਾਂ ਤਰੀਕ ਨੂੰ ਸਵੇਰੇ ਵ ਸਵੇਰ ਵਕਤ ਹੀ ਡਿਲੀਵਰ ਹੋ ਗਿਆ ਮੈਂ ਸਮ ਸੈਮਸੰਗ ਦਾ ਲੈਪਟੋਪ ਮੰਗਵਾਇਆ ਸੀ ਡਾਰਕ ਬਲੈਕ ਕਲਰ ਦਾ ਅਤੇ ਸੱਚਮੁੱਚ ਇਹ ਬਹੁਤ ਹੀ ਵਧੀਆ ਕੁਆਲਿਟੀ ਦਾ ਨਿਕਲਿਆ ਇਸ ਵਿੱਚ ਕੋਈ ਖਰਾਬੀ ਨਹੀਂ ਹੈ ਅਤੇ ਮੈਨੂੰ ਇੱਕ ਸਾਲ ਦੀ ਗਰੰਟੀ ਵੀ ਮਿਲ ਗਈ ਜੇ ਕੋਈ ਵੀ ਖਰਾਬੀ ਆਉਂਦੀ ਹੈ ਤਾਂ ਪੂਰਾ ਖਰਚਾ ਕੋਂਪਨੀ ਵਾਲਿਆਂ ਨੂੰ ਕਰਨਾ ਪਵੇਗਾ